ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੈ ਮੈਂ ਕਈ ਥਾਵਾਂ 'ਤੇ ਘੁੰਮਣ ਫਿਰਨ ਗਿਆ ਹਾਂ ਮੈਂ ਵਿਦੇਸ਼ਾਂ ਵਿੱਚ ਵੀ ਘੁੰਮਣ ਫਿਰਨ ਗਿਆ ਸੀ ਮੈਂ ਭਾਰਤ ਵਿੱਚ ਤਾਜ ਮਹਿਲ ਦੇਖਿਆ ਹੈ ਉਹ ਬਹੁਤ ਹੀ ਖੂਬਸੂਰਤ ਹੈ ਵਾਰ ਵਾਰ ਦੇਖਣ ਨੂੰ ਜੀ ਕਰਦਾ ਹੈ ਇਹ ਸ਼ਾਹ ਜਹਾਨ ਨੇ ਮੁਮਤਾਜ਼ ਦੀ ਯਾਦ ਵਿੱਚ ਬਣਾਇਆ ਸੀ ਅੰਮ੍ਰਿਤਸਰ ਵਿੱਚ ਵੀ ਦਰਬਾਰ ਸਾਹਿਬ ਵੀ ਮੈਂ ਦੇਖਣ ਗਿਆ ਸੀ ਦਰਬਾਰ ਸਾਹਿਬ ਪੂਰੇ ਵਰਡ ਵਿੱਚ ਬਹੁਤ ਹੀ ਮਸ਼ਹੂਰ ਹੈ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਹਨ ਦਰਬਾਰ ਸਾਹਿਬ ਜਾ ਕੇ ਮਨ ਨੂੰ ਬਹੁਤ ਹੀ ਆਨੰਦ ਆਉਂਦਾ ਹੈ ਅਤੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਉੱਥੇ ਜਾ ਕੇ ਮੈਂ ਸੇਵਾ ਵੀ ਕਰਦਾ ਹਾਂ ਅਤੇ ਉਸ ਤੋਂ ਬਾਅਦ ਬਾਣੀ ਵੀ ਸੁਣੀ ਜਾਂਦੀ ਤਾਂ